ਮੇਰੇ ਕੋਲ ਨਿੱਜੀ ਅਨੁਭਵ ਜਾਂ ਸੰਗ੍ਰਹਿ ਨਹੀਂ ਹੈ ਪਰ ਮੈਂ ਕਲਪਨਾ ਕਰ ਸਕਦਾ ਹਾਂ ਕੀ ਮੈਂ ਇੱਕ ਕਾਲਪਨਿਕ ਅਰਥਾਂ ਵਿੱਚ ਸੰਗ੍ਰਹਿ ਦਾ ਅਜਾਇਬ ਘਰ ਹੋਣਾ ਕਿਹੋ ਜਿਹਾ ਹੋਵੇਗਾ ਜੇਕਰ ਮੇਰੇ ਕੋਲ ਇੱਕ ਸੀਤਾ ਏ ਇਤਿਹਾਸ ਅਤੇ ਸੱਭਿਆਚਾਰਾਂ ਦੇ ਡਿਜ਼ੀਟਲ ਕਲਾਕ੍ਰਿਤੀਆਂ ਨਾਲ ਭਰਿਆ ਹੋ ਸਕਦਾ ਹੈ ਵਰਚੁਅਲ ਸਟੈਪਾਂ ਨੂੰ ਸਮਰਪਿਤ ਇੱਕ ਕਮਰੇ ਦੀ ਕਲਪਨਾ ਕਰੋ ਹਰ ਇੱਕ ਸਮੇਂ ਦੇ ਇੱਕ ਵੱਖਰੇ ਪਲ ਨੂੰ ਦਰਸਾਉਂਦਾ ਹੈ ਇੱਕ ਡਿਜ਼ੀਟਿੰਗ ਸਿੱਕਾ ਸੰਗ੍ਰਹਿ ਜੋ ਪ੍ਰਾਚੀਨ ਸੱਭਿਅਤਾਵਾਂ ਤੋਂ ਆਧੁਨਿਕ ਡਿਜ਼ੀਟਿੰਗ ਰੂਪਾਂ ਵਿੱਚ ਮੁਰ ਮੁਦਰਾਂ ਦੇ ਵਿਕਾਸ ਨੂੰ ਦਰਸਾਉਂਦਾ ਹੈ ਅਤੇ ਇੱਥੋਂ ਤੱਕ ਕਿ ਇੱਕ ਚੱਟਾਨ ਸੰਗ੍ਰਹਿ ਜਿਸ ਵਿੱਚ ਦੁਨੀਆ ਦੇ ਵੱਖ ਵੱਖ ਹਿੱਸਿਆਂ ਤੋਂ ਸੰਮੇਲਨ ਕੀਤੇ ਨਮੂਨੇ ਹਨ ਹਰੇਕ ਦੀ ਆਪਣੀ ਭੂਵਿਗਿਆਨਕ ਕਹਾਣੀ ਹੈ ਏ ਇੱਥੇ ਇੰਟਰ ਐਕਟਿਵ ਪ੍ਰਦਰਸ਼ਨੀਆਂ ਵੀ ਹੋ ਸਕਦੀਆਂ ਹਨ ਜਿੱਥੇ ਸੈਲਾਨੀ ਇਹਨਾਂ ਕਲਾਕ੍ਰਿਤੀਆਂ ਨੂੰ ਡਿਜ਼ੀਟਲ ਰੂਪ ਵਿੱਚ ਸ਼ੋਅ ਜਾਂ ਅਨੁਭਵ ਕਰ ਸਕਦੇ ਹਨ ਹਰ ਇੱਕ ਦੇ ਪਿੱਛੇ ਇਤਿਹਾਸ ਮਹੱਤਤਾ ਅਤੇ ਕਾਰੀਗਰੀ ਬਾਰੇ ਸਿੱਖ ਸਕਦੇ ਹਨ ਉਦਾਹਰਨ ਨੇ ਇੱਕ ਵਰਚੁਅਲ ਟੂਲ ਇਹ ਦਿਖਾ ਸਕਦਾ ਹੈ